ਹਾਂ ਜਿਹੜੇ ਵੀ ਬਾਹਰੋਂ ਟੂਰਿਸਟ ਆਉਂਦੇ ਹੈ ਸਾਡੇ ਰਾਜ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਓ ਉਹਨਾਂ ਲਈ ਸਾਡੇ ਜਿਹੜਾ ਹੈਗਾ ਇਹਦਾ ਪਾਰਟੀਸ਼ਨ ਮਿਊਜ਼ਅਮ ਹੈ ਵੈ ਅਤੇ ਜਲ੍ਹਿਆ ਵਾਲੇ ਬਾਗ ਉਹ ਜਾ ਸਕਦੇ ਹੈ ਅਟਾਰੀ ਬੋਡਰ ਜਾ ਸਕਦੇ ਨੇ ਫਿਰ ਹੈ ਗੋਬਿੰਦ ਕਿਲ੍ਹਾ ਗੋਬਿੰਦਗੜ੍ਹ ਜਾ ਸਕਦੇ ਹੈ ਜਿਹਦੇ ਬਾਰੇ ਜਿਹਦੇ ਵਿੱਚ ਸਾਡੇ ਬਾਰੇ ਸਾਡੇ ਰਾਜ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਕਾਫ਼ੀ ਕੁਛ ਦੱਸਿਆ ਹੋਇਆ ਹੈ ਔਰ ਇਹ ਹੀ ਸੱਭਿਆਚਾਰ ਸਾਡੇ ਦੁਰਗਿਆਨਾ ਟੈਂਪਲ ਤੋਂ ਵੀ ਪ੍ਰਾਪਤ ਕਰ ਸਕਦੇ ਹੈ ਜਲ੍ਹਿਆਂ ਵਾਲੇ ਬਾਗ 'ਚ ਜਾ ਕੇ ਤੁਹਾਨੂੰ ਪਤਾ ਚੱਲ ਸਕਦਾ ਕਿ ਕਿੰਨਾ ਕੁ ਸ ਸਾਡਾ ਹਰ ਕਿੰਨਾ ਕੁ ਸਾਡਾ ਸੱਭਿਆਚਾਰ ਡਿਵੈਲਪ ਹੋ ਚੁੱਕਾ ਹੈ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਸੱਭਿਆਚਾਰ ਦਾ ਬਾਰੇ ਕਿ ਦੱਸਿਆ ਜਾਂਦਾ ਹੈ ਕਿ ਉਹਦੇ 'ਚ ਚਾਰ ਗੇਟ ਲੱਗੇ ਹੋਏ ਨੇ ਔਰ ਚਾਰੋਂ ਗੇਟ ਚਾਰੇ ਧਰਮਾਂ ਦੇ ਕੀ ਛੱਡ ਕੇ ਸਾਰੇ ਧਰਮਾਂ ਦੇ ਵਾਸਤੇ ਖੋਲਿਆ ਹੋਇਆ ਹੈ ਕੋਈ ਵੀ ਧਰਮ ਦਾ ਲੋਕ ਉੱਥੇ ਜਾ ਸਕਦਾ ਅਤੇ ਸਾਡਾ ਦੇਸ਼ ਜਿਹੜੀ ਸਾਡੇ ਰਾਜ ਦਾ ਇਤਿਹਾਸ ਹੈ ਸਾਰੇ ਧਰਮਾਂ ਲਈ ਇੱਕੋ ਜਿਹਾ ਓਪਨ ਹੈਗਾ ਹੈ ਔਰ ਸਾਡੀ ਵਿਰਾਸਤ ਇੰਨੀ ਰਿਚ ਹੈਗੀ ਹੈ ਕਿ ਇਹਦੇ ਬਾਰੇ ਬਾਹਰੋਂ ਟੂਰਿਸਟ ਆ ਕੇ ਖੁਸ਼ ਹੁੰਦੇ ਹੈ ਦੇਖ ਕੇ ਕਿ ਇੱਥੇ ਇੱਕ ਇੱਥੇ ਸਾਡੇ ਦਰਬਾਰ ਸਾਹਿਬ 'ਚ ਲੰਗਰ ਘਰ ਹੈ ਜਿੱਥੇ ਕਿ ਹਰ ਧਰਮ ਦੇ ਲੋਕ ਆ ਕੇ ਚੌਵੀ ਘੰਟੇ ਖੁੱਲਿਆ ਰਹਿੰਦਾ ਖਾ ਸਕਦੇ ਨੇ ਸਭ ਕੁਛ ਇਹਨਾਂ ਦੇ ਪੁਰਾਣੇ ਜੋ ਵੀ ਇਹਨਾਂ ਦੇ ਰਾਜਿਆਂ ਦੇ ਟਾਈਮ ਜੋ ਵੀ ਇਹ ਸ਼ਸਤਰ ਵਗੈਰਾ ਯੂਜ ਕਰਦੇ ਸੀ ਸਭ ਕੁਛ ਇਤਿਹਾਸ ਇੱਥੋਂ ਸਾਰਾ ਪਤਾ ਚ ਕਰ ਸਕਦੇ ਹੈ ਕਿਲ੍ਹਾ ਗੋਬਿੰਦਗੜ੍ਹ 'ਚ ਵੀ ਸਾਡੇ ਪੁਰਾਣੇ ਲੋਕ ਕਿਸ ਤਰ੍ਹਾਂ ਯੂਜ ਕਰਦੇ ਸੀ ਚੀਜ਼ਾਂ ਉਹ ਸਾਡਾ ਸਾਰਾ ਸੱਭਿਆਚਾਰ ਉਹਦੇ 'ਚ ਦਰਸਾਇਆ ਗਿਆ ਹੋਇਆ ਹੈ